ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਬਹੁਤ ਜਾ ਜ਼ਿਆਦੇ ਵੱਧ ਗਈਆਂ ਹਨ ਬਠਿੰਡਾ ਖੇਤਰ ਵਿੱਚ ਤਾਂ ਇੱਥੋਂ ਦਾ ਪਾਣੀ ਅਤੇ ਇੱਥੋਂ ਦੀ ਹਵਾ ਹੀ ਐਵੇਂ ਦੇ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਲਈ ਬਹੁਤ ਹੀ ਵੱਡੀ ਸਮੱਸਿਆ ਬਣਿਆ ਹੋਇਆ ਹੈ ਇਸ ਨਾਲ ਬਹੁਤ ਜ਼ਿਆਦੇ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦੀਆਂ ਬਿਮਾਰੀਆਂ ਬਹੁਤ ਲੋਕਾਂ ਨੂੰ ਲੱਗ ਰਹੀਆਂ ਹਨ ਸਰਕਾਰ ਵੀ ਇਸ ਲਈ ਕੁਛ ਖਾਸ ਨਹੀਂ ਕਰ ਪਾ ਰਹੀ ਹੈ ਕਿਉਂਕਿ ਸਰਕਾਰ ਲਈ ਵੀ ਹਰ ਇੱਕ ਹਰ ਇੱਕ ਬੰਦੇ ਲਈ ਉਹ ਸੁਵਿਧਾ ਪ੍ਰਬੰਧ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਦੇਖਿਆ ਜਾਵੇ ਤਾਂ ਜੇਕਰ ਸਰਕਾਰ ਇੱਥੋਂ ਤੱਕ ਸਹੂਲਤਾਂ ਪਹੁੰਚਾਉਂਦੀ ਹੈ ਤਾਂ ਉਹਨਾਂ ਨੂੰ ਸਰਕਾਰ ਨੂੰ ਇਸ ਵਿੱਚ ਬਹੁਤ ਹੀ ਜ਼ਿਆਦਾ ਮ ਮਹਿੰਗਾ ਪੈਂਦਾ ਹੈ ਅਤੇ ਹਰ ਇੱਕ ਬੰਦਾ ਇਹਨਾਂ ਸਹੂਲਤਾਂ ਨੂੰ ਲੈ ਵੀ ਨਹੀਂ ਪਾ ਰਿਹਾ ਕਿਉਂਕਿ ਇਹ ਬਹੁਤ ਮਹਿੰਗੀਆਂ ਹਨ ਜਿਵੇਂ ਕਿ ਤੁਸੀਂ ਕੀਮੋ ਨੂੰ ਕੀਮੋ ਅਤੇ ਫਿਜੀਓਥੈਰਪੀ ਦਾ ਹੀ ਗੱਲ ਕਰੀਏ ਤਾਂ ਆਪਾਂ ਇਹ ਬਹੁਤ ਹੀ ਮਹਿੰਗੇ ਹੈ ਹਰ ਇੱਕ ਗਰੀਬ ਬੰਦਾ ਤਾਂ ਇਹ ਸਭ ਨਹੀਂ ਖਰੀਦ ਸਕਦਾ ਜੋ ਪੈਸੇ ਵਾਲਾ ਬੰਦਾ ਹੈ ਉਹ ਤਾਂ ਆਪਣਾ ਇਲਾਜ ਕਰਵਾ ਸਕਦਾ ਹੈ ਜੋ ਗਰੀਬ ਬੰਦਾ ਹੈ ਉਹ ਮਰ ਜਾਂਦਾ ਅਤੇ ਜੇ ਦੇਖਿਆ ਜਾਵੇ ਡਾਇਲਸਿਸ ਵਗੈਰਾ ਦੀ ਗੱਲ ਕਰਦੇ ਹਾਂ ਆਪਾਂ ਤਾਂ ਡਾਇਲਾਸਿਸ ਵਗੈਰਾ ਵੀ ਬਹੁਤ ਮਹਿੰਗਾ ਹੈ ਜੋ ਕਿ ਹਰ ਇੱਕ ਬੰਦਾ ਨਹੀਂ ਕਰਵਾ ਸਕਦਾ ਇਸ ਲਈ ਇਹ ਇੱਕ ਬਹੁਤ ਹੀ ਵੱਡੀ ਸਮੱਸਿਆ ਬਣਿਆ ਹੋਇਆ ਹੈ ਧੰਨਵਾਦ